ਪ੍ਰਦਰਸ਼ਨ ਨੂੰ ਵਧਾਉਣ ਲਈ ਅਸੀਂ ਆਪਣੇ ਚਿਹਰੇ 'ਤੇ ਕਈ ਸਾਰੇ ਹਾਵ ਭਾਵਾਂ ਦੀ ਵਰਤੋਂ ਕਰ ਸਕਦੇ ਹਾਂ ਜਿਵੇਂ ਕਿ ਪ੍ਰਦਰਸ਼ਨ ਨੂੰ ਵਧਾਉਣ ਲਈ ਅਸੀਂ ਗਾਉਂਦੇ ਸਮੇਂ ਆਪਣੀਆਂ ਅੱਖਾਂ ਦਾ ਵੀ ਇਸਤੇਮਾਲ ਕਰ ਸਕਦੇ ਹਾਂ ਇਸ ਨਾਲ ਦੂਸਰੇ ਬੰਦੇ ਦੀ ਅੱਖਾਂ ਵਿੱਚੋਂ ਪੜ੍ਹ ਕੇ ਅਸੀਂ ਇਹ ਜਾਣ ਸਕਦੇ ਹਾਂ ਕਿ ਉਹ ਕਿਵੇਂ ਦਾ ਮਹਿਸੂਸ ਕਰ ਰਿਹਾ ਹੈ ਅਤੇ ਹੋਰ ਵੀ ਜਿਵੇਂ ਕਿ ਅਸੀਂ ਗਾਉਂਦੇ ਸਮੇਂ ਆਪਣੇ ਬੁੱਲਾਂ ਦਾ ਵੀ ਇਸਤੇਮਾਲ ਕਰ ਸਕਦੇ ਹਾਂ ਅਤੇ ਨਾਲ ਹੀ ਇਸ ਨੂੰ ਗਾਉਦੇਂ ਸਮੇਂ ਅਸੀਂ ਆਪਣੇ ਚਿਹਰੇ ਅਤੇ ਹਾਸੇ ਦਾ ਵੀ ਪ੍ਰਯੋਗ ਵੀ ਕਰ ਸਕਦੇ ਹਾਂ ਕਿਉਂਕਿ ਜੇਕਰ ਸਾਡੇ ਚਿਹਰੇ 'ਤੇ ਮੁਸਕਰਾਹਟ ਹੋਏਗੀ ਤਾਂ ਅਗਲੇ ਬੰਦੇ ਨੂੰ ਇਹ ਲੱਗੇਗਾ ਕਿ ਬੰਦਾ ਮੁਸਕੁਰਾ ਰਿਹਾ ਹੈ ਇਸ ਲਈ ਕਈ ਸਾਰੇ ਕਈ ਸਾਰੇ ਹਾਵ ਭਾਵਾਂ ਦੀ ਵਰਤੋਂ ਕਰਕੇ ਅਸੀਂ ਪ੍ਰਦਰਸ਼ਨ ਨੂੰ ਵਧੀਆ ਮਹਿਸੂਸ ਕਰਵਾ ਸਕਦੇ ਹਾਂ